ਅਤੇ ਮੋਹਾਲੀ ਜ਼ਿਲ੍ਹੇ ਵਿੱਚ ਸਥਾਨਿਕ ਚੈਰਿਟੀ ਭਾਈਚਾਰਿਕ ਸੰਸਥਾਵਾਂ ਹਨ ਜੋ ਕਿ ਪ੍ਰਭ ਆਸਰਾ ਅਤੇ ਰਤਵਾੜਾ ਸਾਹਿਬ ਬਿਰਧ ਆਸ਼ਰਮ ਹੈ ਜੋ ਕਿ ਬੱਚਿਆਂ ਦੀ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਲਈ ਹੈ